ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਅੱਛਾ ਜੀ ਕੋਈ ਨਹੀਂ ਮੈਮ ਤੁਸੀਂ ਆ ਕਿਵੇਂ ਦਾ ਸੂਟ ਸਿਲਾਈ ਕਰਵਾਉਣਾ ਤੁਸੀਂ ਤੁਹਾਨੂੰ ਕਦੋਂ ਚਾਹੀਦਾ ਮੈਮ ਹਾਂਜੀ ਕੋਈ ਨਹੀਂ ਮੈਮ ਮਿਲ ਜੂਗਾ ਤੁਹਾਨੂੰ ਕਿਵੇਂ ਦਾ ਹੈ ਮਤਲਬ ਸੂਟ ਮੈਮ ਪਲੇਟਾਂ ਵਾਲਾ ਹੈ ਜਾਂ ਫਿਰ ਸਿੰਪਲ ਹੈ ਪਲਾਜ਼ੋ ਵਾਲਾ ਹੈ ਲਾਈਨਿੰਗ ਵਾਲਾ ਹੈ ਕਿਵੇਂ ਦਾ ਹੈ ਸੂਟ ਓਕੇ ਮੈਮ ਤੁਹਾਡਾ ਮਤਲਬ ਮੇਜ਼ਰਮੈਂਟ ਫਿਰ ਤੁਸੀਂ ਆਉਂਗੇ ਕਿ ਫ਼ੋਨ 'ਤੇ ਹੀ ਲਿਖਵਾਉਣਾ ਹੈ ਅੱਛਾ ਜੀ ਹਾਂਜੀ ਮੈਮ ਤੁਹਾਡਾ ਤੀਰਾ ਕਿੰਨਾ ਹੈ ਜੀ ਠੀਕ ਹੈ ਜੀ ਤੁਹਾਡੀ ਕਮਰ ਮੋਢਾ ਅੱਛਾ ਜੀ ਉਸ ਤੋਂ ਬਾਅਦ ਤੁਹਾਡੀ ਹਿੱਪ ਕਿੰਨੀ ਹੈ ਜੀ ਔਰ ਪੱਲਾ ਕਿੰਨਾ ਰੱਖਣਾ ਤੁਸੀਂ ਠੀਕ ਹੈ ਜੀ ਔਰ ਤੁਸੀਂ ਮਤਲਬ ਗਲਾ ਜ਼ਿਆਦਾ ਡੀਪ ਪਾਉਂਦੇ ਹੈ ਕਿ ਨੌਰਮਲ ਹੀ ਪਾਉਂਦੇ ਹੈ ਅੱਛਾ ਜੀ ਔਰ ਬਾਂਹ ਦੀ ਲੰਬਾਈ ਕਿੰਨੀ ਰੱਖਣੀ ਹੈ ਜੀ ਔਰ ਮੂਰੀ ਬਾਂਹ ਦੀ ਅੱਛਾ ਜੀ ਠੀਕ ਹੈ ਜੀ ਪਲੇਟਾਂ ਜਿਹੜੀਆਂ ਤੁਸੀਂ ਮਤਲਬ ਪਾਉਣੀਆਂ ਹੈ ਉਹ ਸਿੱਧੀਆਂ ਵਾਲੀਆਂ ਹੀ ਪਾਉਣੀਆਂ ਹੈ ਕਿ ਸਾਈਡ ਵਾਲੀਆਂ ਵੀ ਪਾਣੀਆਂ ਹੈ ਜੀ ਠੀਕ ਹੈ ਜੀ ਔਰ ਜਿਹੜਾ ਦੂਸਰਾ ਸੂਟ ਹੈ ਸਿੰਪਲ ਵਾਲਾ ਉਹਨਾਂ ਦਾ ਉਸਦਾ ਨਾਪ ਜੀ ਉਹ ਅਲੱਗ ਹੈ ਉਹ ਹੋਰ ਕਿਸੀ ਦਾ ਹੈ ਕਿ ਤੁਹਾਡਾ ਹੀ ਹੈ ਜੀ ਉਹਦਾ ਵੀ ਲਿਖਵਾ ਦਿਓ ਜੀ ਫਿਰ ਹਾਂਜੀ ਲਿਖ ਲਿਆ ਜੀ ਅੱਗੇ ਜੀ ਛਾਤੀ ਠੀਕ ਹੈ ਜੀ ਉਸ ਤੋਂ ਬਾਅਦ ਹਿੱਪ ਠੀਕ ਹੈ ਜੀ ਉਸ ਤੋਂ ਬਾਅਦ ਪੱਲਾ ਠੀਕ ਹੈ ਜੀ ਬਾਂਹ ਦੀ ਲੰਬਾਈ ਹੈਲੋ ਠੀਕ ਹੈ ਜੀ ਔਰ ਫਿਰ ਮਤਲਵ ਕੀ ਬਾਂਹ ਸਿੰਪਲ ਹੀ ਬਣਾਉਣੀ ਹੈ ਕੀ ਕੋਈ ਕਫ ਵਗੈਰਾ ਲਗਾ ਕੇ ਬਣਾਉਣੇ ਹੈ ਜਿੱਦਾਂ ਅੱਜ ਕੱਲ੍ਹ ਚੱਲ ਰਹੀਆਂ ਡਿਜ਼ਾਈਨਰ ਠੀਕ ਹੈ ਜੀ ਠੀਕ ਹੈ ਜੀ ਬਾਕੀ ਚੱਲੋ ਤੁਸੀਂ ਆ ਜਾਇਓ ਸਾਡੀ ਸ਼ੌਪ 'ਤੇ ਫਿਰ ਬਾਕੀ ਜਿਹੜਾ ਕੁਛ ਰਹਿ ਗਿਆ ਜੇ ਤੁਹਾਨੂੰ ਨਹੀਂ ਪਤਾ ਲੱਗਿਆ ਤਾਂ ਤੁਸੀਂ ਦੁਕਾਨ 'ਤੇ ਆ ਜਾਇਓ ਤੁਹਾਨੂੰ ਦੱਸ ਦੇਵਾਂਗੇ ਜੀ ਠੀਕ ਹੈ ਜੀ ਓਕੇ ਜੀ ਠੀਕ ਹੈ ਜੀ ਥੈਂਕ ਯੂ ਜੀ